ਪੇਂਟਿੰਗ ਇੱਕ ਬਹੁਤ ਵਧੀਆ ਕਲਾ ਹੈ ਪੇਂਟਿੰਗ ਦੇ ਬਹੁਤ ਸਾਰੇ ਮੁਕਾਬਲੇ ਕੀਤੇ ਜਾਂਦੇ ਹਨ ਪੇਂਟਿੰਗਾਂ ਬਹੁਤ ਜਗ੍ਹਾ 'ਤੇ ਕੀਤੀ ਜਾਂਦੀ ਹੈ ਪੇਂਟਿੰਗ ਚਿੱਤਰਕਾਰੀ ਦੀ ਇੱਕ ਚਿੱਤਰਕਾਰੀ ਦਾ ਇੱਕ ਹਿੱਸਾ ਹੈ ਪੇਂਟਿੰਗ ਨੂੰ ਚਿੱਤਰਕਾਰੀ ਵਿੱਚ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਅੱਜ ਕੱਲ੍ਹ ਪੇਂਟਿੰਗ ਕਰਨਾ ਆਮ ਹੋ ਗਿਆ ਹੈ ਹਰ ਇੱਕ ਦਾ ਪੇਸ਼ਾ ਪੇਂਟਿੰਗ ਹੈ ਪੇਂਟਿੰਗ ਨਾਲ ਪੇਂਟਿੰਗ ਹਰ ਸਾਨੂੰ ਕੁਦਰਤੀ ਚੀਜ਼ਾਂ ਦੀ ਪੇਂਟਿੰਗ ਬਣਾਉਣੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਰੁੱਖ ਹੁੰਦੇ ਹਨ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਜੇਕਰ ਅਸੀਂ ਕੁਦਰਤੀ ਚੀਜ਼ਾਂ ਦੀ ਪੇਂਟਿੰਗ ਬਣਾਉਂਦੇ ਹਾਂ ਤਾਂ ਉਹਨਾਂ ਨੂੰ ਸਾਡੇ ਤੋਂ ਇਹ ਪ੍ਰੇਰਿਤ ਕੀਤਾ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਅਰਥ ਨੂੰ ਬਚਾਉਣਾ ਚਾਹੀਦਾ ਹੈ ਪ੍ਰਦੂਸ਼ਣ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੂੜਾ ਨਹੀਂ ਸਿੱਟ ਸੁੱਟਣਾ ਚਾਹੀਦਾ ਬਾਹਰ ਡਸਟਬਿਨ 'ਚ ਪਾਉਣਾ ਚਾਹੀਦਾ ਹੈ ਬਹੁਤ ਸਾਰੀ ਚੀਜ਼ਾਂ ਦੀ ਪੇਂਟਿੰਗ ਹੁੰਦੀ ਹੈ ਪੇਂਟਿੰਗ ਵਿੱਚੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੁੰਦਾ ਹੈ ਪੇਂਟਿੰਗ ਇੱਕ ਅਜਿਹਾ ਨਜ਼ਰੀਆ ਹੈ ਜੇਕਰ ਉਸਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹ ਸਾਨੂੰ ਕਈ ਚੀਜ਼ਾਂ ਤੋਂ ਪ੍ਰੇਰਿਤ ਕਰਦਾ ਹੈ ਪਰੇ ਪੇਂਟਿੰਗ ਨੂੰ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ